ਹੈਲੋ ਵਧੀਆ ਵਧੀਆ ਬਾਈ ਤੂੰ ਸੁਣਾ ਬਈ ਮੈਂ ਅੱਜ ਮਨੀ ਹਿਸਟ ਵਾਲੀ ਬੁੱਕ ਪੜ੍ਹੀ ਸਟੋਰੀ ਸਟੋਰੀ ਬੁੱਕ ਆ ਬਈ ਬਹੁਤ ਘੈਂਟ ਆ ਬਈ ਯਾਰ ਮੈਂ ਪੜ੍ਹੀ ਯਾਰ ਮੈਂ ਤਾਂ ਅੰਦਰ ਹੀ ਖੂੱਬ ਗਿਆ ਸੀਗਾ ਬਈ ਮਤਲਬ ਕਿ ਇਹਦੇ ਵਿੱਚ ਕਰੈਕਟਰ ਹੁੰਦੇ ਹੈ ਮਨੀ ਹਿਸਟ ਦੇ ਮਤਲਬ ਕਿ ਬਹੁਤ ਮਤਲਬ ਕਿ ਗਿਆਰਾਂ ਕ ਏ ਕਰੈਕਟਰ ਹੁੰਦੇ ਆ ਅਤੇ ਸਟੋਰੀ ਬਈ ਮੈਂ ਦੱਸਦਾ ਮਤਲਬ ਕਿ ਇਹ ਨਾ ਸਪੈਨ ਸਪੇਨ 'ਚ ਏ ਇਹ ਬੈਂਕ ਚੋਰੀ ਕਰਦੇ ਆ ਮਤਲਬ ਕਿ ਬੈਂਕ 'ਚ ਸੋਨਾ ਹੁੰਦਾ ਕਈ ਵਾਰ ਲੋਕਾਂ ਨੇ ਜਿਹੜਾ ਸੋਨਾ ਜਮ੍ਹਾ ਕਰਦੇ ਆ ਗੋਲਡ ਲੋਨ ਵਾਲੇ ਅਤੇ ਬਈ ਯਾਰ ਉਹਨਾਂ ਨੇ ਸੋਨਾ ਪਿਘਲਾ ਪਿਘਲਾ ਕੇ ਪਤਾ ਕਣਕ ਦੇ ਦਾਣੇ ਜਿੰਨੇ ਜਿੰਨੇ ਦਾਣੇ ਬਣਾ ਕੇ ਨਾ ਉਹਨਾਂ ਨੇ ਪਇਪਾਂ ਥ੍ਰੂ ਪਤਾ ਨਹੀਂ ਕਿੱਧਰ ਕੱਢਿਆ ਬਈ ਪ੍ਰੋਫੈਸਰ ਦਾ ਦਿਮਾਗ ਬਈ ਪ੍ਰੋਫੈਸਰ ਕੋਲਜ ਕੋਲ ਜਾ ਕੇ ਵੀ ਐਂ ਮੁੜ ਆਉਂਦਾ ਸੀ ਅਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਸੀਗਾ ਬੜਾ ਬਈ ਬੜਾ ਚਲਾਕ ਆ ਬਈ ਬਹੁਤ ਸੁਣਿਆ ਸੀ ਇਹ ਕਿਤਾਬ ਬਾਰੇ ਅੱਜ ਮੈਂ ਪੜ੍ਹੀ ਤਾਂ ਬਹੁਤ ਸਿਰਾ ਗਈ ਸੀ ਕਿਤਾਬ ਸੀ ਅਤੇ ਉਹ ਮਤਲਬ ਕਿ ਪ੍ਰਫੈਸਰ ਵੀ ਉਹ ਅਤੇ ਫੜ੍ਹ ਲੈਂਦੇ ਆ ਠੀਕ ਆ ਅਤੇ ਟੋਕੀਓ ਉਹਨੂੰ ਮਾਰ ਦਿੰਦੇ ਆ ਠੀਕ ਆ ਫਿਰ ਬਰ ਇੱਕ ਐਂ ਆ ਨਾ ਇਹਦੇ ਸਾਥੀ ਹੁੰਦਾ ਬਰਲਿਨ ਬਰਲਿਨ ਬਈ ਜੋ ਪ੍ਰਫੈਸਰ ਮਤਲਬ ਕਿ ਫਸ ਜਾਂਦਾ ਨਾ ਬਾਹਰ ਫਿਰ ਬਰ ਬਰਲਿਨ ਲੀਡ ਕਰਦਾ ਉਹਨਾਂ ਨੂੰ ਬਈ ਬੜਾ ਤਗੜਾ ਲੀਡ ਕਰਦਾ ਬਈ ਮਤਲਬ ਕਿ ਬਈ ਰੇਟਿੰਗ ਆਪਣੀ ਫੁੱਲ ਹੀ ਫੁੱਲ ਆ ਬਈ ਬਹੁਤ ਸੋਹਣੀ ਸਟੋਰੀ ਆ ਹਾਂ ਬਈ ਤੂੰ ਵੀ ਪੜ੍ਹ ਇੱਕ ਵਾਰ ਬਈ ਬਹੁਤ ਮੁਸ਼ਕਲਾਂ 'ਚ ਨਿਕਲਦਾ ਉਹ ਯਾਰ ਪਤਾ ਹੀ ਨਹੀਂ ਲੱਗਦਾ ਜਿੱਥੇ ਹੁਣ ਜਿਵੇਂ ਹੁਣ ਆਪਾਂ ਨੂੰ ਲੱਗਦਾ ਕਿ ਇੱਥੇ ਬਈ ਫਸ ਗਿਆ ਹੁਣ ਤਾਂ ਫੜੇ ਹੀ ਜਾਣਗੇ ਬਈ ਇੰਨੀ ਗੇਮ ਘੁੰਮਉਂਦਾ ਨਾ ਬਈ ਪੂਰੀ ਗੇਮ ਘੁਮਾ ਕੇ ਉਹ ਸਿਰਾ ਲਗਾ ਦਿੰਦਾ ਬਹੁਤ ਵਧੀਆ ਬੁੱਕ ਆ ਮਤਲਬ ਕਿ ਬਈ ਬਹੁਤ ਸਾਰੇ ਮਤਲਬ ਕਿ ਉਹਨੂੰ ਮਤਲਬ ਕਿ ਐਵੇਂ ਨਹੀਂ ਕਹਿੰਦਾ ਕਿ ਪ੍ਰਫੈਸਰ ਕੋਲ ਦਿਮਾਗ ਉਹ ਫਸਦਾ ਨਹੀਂ ਪਰ ਬਹੁਤ ਵਾਰੀ ਫਸਿਆ ਉਹ ਪਰ ਉਹਨੇ ਬਈ ਦਿਮਾਗ ਲਾ ਕੇ ਬਈ ਜਿਹੜਾ ਨਿਕਲਿਆ ਉਹ ਸਿਰਾ ਕੋਈ ਨਹੀਂ ਨਿਕਲ ਸਕਦਾ ਬਈ ਇੰਨਾ ਮੈਨੂੰ ਪਤਾ ਹਾਰ ਨਹੀਂ ਮੰਨੀ ਬਈ ਦਿਮਾਗ ਹੀ ਲਾਈ ਗਿਆ ਬਈ ਬਹੁਤ ਸਿਰਾ ਸੀਗਾ ਮਤਲਬ ਕਿ ਇਹਤੋਂ ਆਪਾਂ ਨੂੰ ਮੋ ਮਤਲਬ ਕਿ ਮਿਲਦਾ ਸਿੱਖਣ ਨੂੰ ਪਤਾ ਕਿ ਮਿਲਦਾ ਜਿੱਦਾਂ ਦੀ ਮਰਜੀ ਹਾਲਾਤ ਹੋਵੇ ਬੰਦਾ ਬਈ ਉਹ ਹਾਲਾਤਾਂ 'ਚੋਂ ਨਿਕਲ ਹੀ ਜਾਂਦਾ ਜਿਵੇਂ ਮਰਜ਼ੀ ਨਿਕਲ ਜਾਂਦਾ ਪਰ ਨਿਕਲ ਹੀ ਜਾਂਦਾ ਇਹ ਬੁੱਕ ਆਪਾਂ ਨੂੰ ਇਹ ਸਿਖਾਉਂਦੀ ਆ ਬਹੁਤ ਸਿਰਾ ਬੁੱਕ ਆ ਯਾਰ ਇੱਕ ਵਾਰ ਪੜ੍ਹ ਕੇ ਵੇਖੀ ਤੂੰ ਵੀ ਮੇਰੇ ਕੋਲੋਂ ਲੈ ਜਾਈਂ ਮੈਂ ਓਨਲਾਈਨ ਮੰਗਵਾਈ ਸੀ ਬਈ ਯਾਰ ਮੈਂ ਤਾਂ ਪਹਿਲਾਂ ਦੇਖਿਆ ਵੀ ਸਾਰੇ ਮਨੀ ਹਿਸਟ ਦੀ ਗੱਲ ਕਰਦੇ ਆ ਮੈਂ ਕਿਹਾ ਮੈਂ ਵੀ ਯਾਰ ਮੰਗਵਾ ਕੇ ਦੇਖਾ ਤਾਂ ਬਈ ਮਨੀ ਹਿਸਟ ਬਈ ਮੇਰਾ ਤਾਂ ਹੁਣ ਜੀਅ ਕਰਦਾ ਮੈਂ ਦੂਜੀ ਵਾਰ ਵੀ ਪੜ੍ਹਾ ਬਈ ਮੈਂ ਬਾਕੀ ਵੀ ਸਟੋਰੀਆਂ ਪੜ੍ਹੀਆਂ ਪਰ ਮੈਨੂੰ ਜ਼ਿਆਦਾ ਇੰਟਰਸਟਿੰਗ ਆਹ ਲੱਗ ਬਈ ਉਹ ਯਾਰ ਬਾਹਲੀ ਸਿਰਾ ਯਾਰ ਤੂੰ ਇੱਕ ਵਾਰ ਪੜ੍ਹ ਕੇ ਤਾਂ ਦੇਖ ਮੇਰੇ ਕੋਲ ਲੈ ਜਾਈਂ ਮੇਰੇ ਕੋਲ ਪਈ ਆ ਮੈਂ ਹੁਣ ਪੜ੍ਹ ਲਈ ਆ ਹੁਣ ਮੈਂ ਦੂਜੀ ਵਾਰ ਫਿਰ ਪੜੂਗਾ ਠੀਕ ਆ ਹਾਂ ਹਾਂ ਠੀਕ ਆ ਬਈ ਚਲ ਠੀਕ ਆ ਬਈ